ਹਾਂ ਮੈਂ ਬਹੁਤ ਵਾਰੀ ਜਿਹੜੀ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦਾ ਪ੍ਰਯੋਗ ਕੀਤਾ ਜਿਹੜੀ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਹੁੰਦੀ ਹੈ ਜਿਵੇਂ ਆਪਾਂ ਪੁਰਾਣੇ ਸਮੇਂ ਵਿੱਚ ਪਹਿਲਾਂ ਬਲੈਕ ਐਂਡ ਵਾਈਟ ਫੋਟੋ ਦਾ ਹੀ ਪ੍ਰਯੋਗ ਕੀਤਾ ਜਾਂਦਾ ਸੀ ਕਿਉਂਕਿ ਉਦੋਂ ਜਿਹੜੇ ਡਿਜਿਟਲ ਅੱਜ ਕੱਲ੍ਹ ਜੋ ਕੈਮਰੇ ਨੇ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਉਦੋਂ ਬਲੈਕ ਐਡ ਵਾਈਟ ਹੀ ਫੋਟੋ ਹੁੰਦੀ ਸੀ ਆਪਾਂ ਪੁਰਾਣੇ ਜ਼ਮਾਨੇ ਆਪਣੇ ਬਜ਼ੁਰਗਾਂ ਦੀਆਂ ਫੋਟੋਆਂ ਦੇਖਦੇ ਹਾਂ ਉਹਦੇ ਵਿੱਚ ਸਿਰਫ ਇੱਕ ਰੰਗ ਦੀਆਂ ਹੀ ਫੋਟੋਆਂ ਹੁੰਦੀਆਂ ਸੀ ਜਿਵੇਂ ਕਿ ਗਰੇ ਕਲਰ ਦੀਆਂ ਫੋਟੋਆਂ ਸੀ ਜ਼ਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਸੀਗੀਆਂ ਪਰੰਤੂ ਆਪਾਂ ਅੱਜ ਕੱਲ੍ਹ ਵੀ ਬਹੁਤ ਸਾਰੇ ਜਿਵੇਂ ਸ਼ੌਕੀਆ ਤੌਰ 'ਤੇ ਬਲੈਕ ਐਂਡ ਵਾਈਟ ਫੋਟੋ ਦਾ ਪ੍ਰਯੋਗ ਕਰਦੇ ਹਾਂ ਜਿਵੇਂ ਕਿ ਆਪਾਂ ਮੋਬਾਇਲ ਫੋਨ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਵੇਂ ਫੀਚਰ ਤਰ੍ਹਾਂ ਤਰ੍ਹਾਂ ਦੇ ਫਿਲਟਰ ਹੁੰਦੇ ਹਨ ਉਹਦੇ ਵਿੱਚ ਬਲੈਕ ਐਂਡ ਵਾਈਟ ਫਿਲਟਰ ਵੀ ਹੁੰਦਾ ਹੈ ਜਿੱਦਾਂ ਆਪਾਂ ਪ੍ਰਯੋਗ ਕਰਕੇ ਆਪਾਂ ਬਲੈਕ ਐਂਡ ਵਾਈਟ ਫੋਟੋਆਂ ਖਿੱਚਦੇ ਹਾਂ ਜਿਹੜੇ ਮੋਨੋਕੋਮੈਟਿਕ ਚਰਿੱਤਰ ਹੁੰਦੇ ਨੇ ਇਹਦੇ ਵਿੱਚ ਕੀ ਹੁੰਦਾ ਇਸ ਵਿੱਚ ਇੱਕ ਰੰਗ ਇੱਕ ਰੰਗ ਦੀਆਂ ਹੀ ਫੋਟੋਆਂ ਹੁੰਦੀਆਂ ਨੇ ਜਿਵੇਂ ਬਲੈਕ ਜਾਂ ਬਲੈਕ ਰੰਗ ਵਿੱਚ ਵਾਈਟ ਰੰਗ ਦਾ ਮਿਕਸ ਕੀਤਾ ਜਾਂਦਾ ਇਸ ਵਿੱਚ ਇੱਕ ਰੰਗ ਦੇ ਜਿਵੇਂ ਗਰੇ ਸਕੇਲ 'ਤੇ ਤਿਆਰ ਕੀਤੇ ਜਾਂਦੀਆਂ ਨੇ ਇਸ ਵਿੱਚ ਜਦੋਂ ਆਪਾਂ ਚਿੱਟੇ ਰੰਗ ਵਿੱਚ ਚਿੱਟੇ ਰੰਗ ਦੀ ਰੰਗਤ ਪ੍ਰਾਪਤ ਕਰਨ ਲਈ ਉਸਨੂੰ ਥੋੜ੍ਹਾ ਜਿਹਾ ਹਲਕਾਪਣ ਵਧਦਾ ਜਾਂਦਾ ਜਦੋਂ ਰੰਗ ਜੋੜ ਕੇ ਕਾਲਾ ਪ੍ਰਾਪਤ ਕਰਨਾ ਤਾਂ ਉੱਥੇ ਦਾ ਹਲਕਾਪਣ ਘਟਦਾ ਜਾਂਦਾ ਅਤੇ ਭੂਰੇ ਰੰਗ ਨੂੰ ਜੋੜ ਕੇ ਪ੍ਰਾਪਤ ਕਰਨ 'ਤੇ ਇਸਦੀ ਰੰਗਹੀਣਤਾ ਹੀ ਘੱਟ ਜਾਂਦੀ ਹੈ ਜਦੋਂ ਇਸ ਵਿੱਚ ਭੂਰਾ ਰੰਗ ਐਡ ਹੋ ਜਾਂਦਾ ਇਸ ਦੀ ਰੰਗਹੀਣਤਾ ਜਿਵੇਂ ਆਪਾਂ ਪਹਿਲਾਂ ਪੁਰਾਣੇ ਸਮੇਂ ਪਿੱਛੇ ਜਿਹੜੀਆਂ ਫੋਟੋਆਂ ਹੁੰਦੀਆਂ ਜੋ ਲਾਲ ਫੋਟੋਆਂ ਹੁੰਦੀਆਂ ਸੀ ਉਸ ਵਿੱਚ ਰੰਗ ਐਡ ਕਰਦੇ ਸੀ ਤਾਂ ਉਸ ਰੰਗਤ ਵੀ ਉਹਨੂੰ ਕਲੈਰਟੀ ਨਹੀਂ ਜ਼ਿਆਦਾ ਵਧੀਆ ਹੁੰਦੀ ਸੀਗੀ ਮੋਨੋਕਰਾਟ ਮੀਨਜ ਜਿਹੜੀਆਂ ਰੰਗ ਦੇ ਸਕੀਮਾਂ ਦਾ ਕਲਾਂ ਦਾ ਵਿਜੁਅਲ ਕਮਨੀਕੇਸ਼ਨ ਸੀਗਾ ਡਿਜ਼ਾਇਨ ਸੀਗਾ ਇਹਦਾ ਮੌਕੇ ਪ੍ਰਦਾਨ ਕਰਦੇ ਨੇ ਕਿਉਂਕਿ ਇਹ ਵਿਪ੍ਰੀਤ ਉਹਨਾਂ ਦੀ ਇੱਕ ਵੱਡੀ ਸ਼੍ਰੇਣੀ ਨੂੰ ਆਗਿਆ ਦਿੰਦੀਆਂ ਹਨ ਜੋ ਧਿਆਨ ਖਿੱਚਣ ਫੋਕਸ ਬਣਾਉਣ ਅਤੇ ਸਪਸ਼ਟਨ ਸਮਰਥਨ ਦੇਣ ਲਈ ਵਰਤੇ ਜਾ ਸਕਦੇ ਨੇ ਮੋਨੋਕ੍ਰੋਮੈਟਿਕ ਰੰਗਾਂ ਦੀ ਵਰਤੋਂ ਵਿਜੁਅਲ ਏਕਤਾ ਦੀ ਮਜ਼ਬੂਤ ਭਾਵਨਾ ਪ੍ਰਦਾਨ ਕਰਦੀ ਪ੍ਰਾਥਮਿਕਤਾ ਰੰਗਾਂ ਦੀ ਵਰਤੋਂ ਦੁਆਰਾ ਸੰਚਾਰ ਦੇ ਉਦੇਸ਼ਾਂ ਵਿੱਚ ਸਹਾਇਤਾ ਕਰ ਸਕਦੀ ਸੀ ਜਿਵੇਂ ਰੰਗ ਦੀ ਵਿਪ੍ਰੀਤ ਸੰਪੇਗ ਗੈਰ ਹਾਜ਼ਰੀ ਵਿੱਚ ਕਿਸੇ ਰੰਗ ਦੀ ਗੈਰ ਹਾਜ਼ਰੀ ਵਿੱਚ ਇਸ ਦੀ ਵਿਭਿੰਨਤਾ ਅਤੇ ਟੈਕਸਟਾਂ ਦੁਆਰਾ ਅਪਸੈਟ ਕੀਤਾ ਜਾ ਸਕਦਾ ਅਪ ਡਾਊਨ ਕੀਤਾ ਜਾਂਦਾ ਜਿਵੇਂ ਬਲੈਕ ਰੰਗ ਵਿੱਚ ਚਿੱਟੇ ਰੰਗ ਨੂੰ ਐਡ ਕੀਤਾ ਜਾਂਦਾ ਜਾਂ ਚਿੱਟੇ ਵਿੱਚ ਕਾਲੇ ਰੰਗ ਨੂੰ ਐਡ ਕੀਤਾ ਜਾਂਦਾ ਉਸੇ ਰੰਗਾਂ ਤੋਂ ਜੇ ਪੇ ਵਿਗਿਆਨਿਕ ਤੌਰ 'ਤੇ ਜਿਹੜਾ ਮੋਨੋਪ੍ਰਮੈਕ ਦੇ ਅਰਥ ਹੈ ਪ੍ਰਕਾਸ਼ ਦੀ ਇੱਕ ਤਰੰਗ ਲੰਬਾਈ ਜਾਂ ਰੇਡੀਏਸ਼ਨ ਕੋਈ ਵੀ ਜਦੋਂ ਇਸਦਾ ਇਸਦਾ ਸਿਰਫ ਇੱਕ ਹੀ ਰੰਗ ਦਾ ਹੋਣਾ ਦਿਖਾਈ ਦੇਣਾ ਅਤੇ ਇਸ ਦਾ ਮਤਲਬ ਹੈ ਕਿ ਵਿਗਿਆਨਿਕ ਅਨੁਸਾਰ ਜਿਹੜੇ ਮੋਨੋਕ੍ਰੈਮੈਟਿਕ ਨੇ ਇਹ ਚਰਿੱਤਰ ਕੇਵਲ ਇੱਕ ਰੰਗ ਦੇ ਹੀ ਹੁੰਦੇ ਹਨ ਹਾਲਾਂਕਿ ਇਹ ਕਾਲੇ ਰੰਗ ਵਿੱਚ ਫਿੱਕੇ ਹੁੰਦੇ ਅਤੇ ਬਣਾਏ ਜਾ ਸਕਦੇ ਹਾਲਾਂਕਿ ਦਾ ਇੱਕ ਅਰਥ ਹੈ ਬੋਰਿੰਗ ਜਾਂ ਰੰਗ ਰਹਿਤ ਮਤਲਬ ਰੰਗ ਰਹਿਤ ਕਿਉਂਕਿ ਇਹਦੇ ਵਿੱਚ ਕੋਈ ਰੰਗ ਨਹੀਂ ਹੁੰਦਾ ਅਤੇ ਇਹ ਕਲਰ ਬਲੈਕ ਐਂਡ ਵਾਈਟ ਅਗਰ ਰੂਪ ਵਿੱਚ ਹੀ ਹੁੰਦੀਆਂ ਨੇ ਇਸ ਵਿੱਚ ਕਈ ਵਾਰ ਰੰਗਾਂ ਦਾ ਰੰਗਦਾਰ ਰੰਗ ਦੀ ਇੱਕ ਰੰਗ ਡਿਜ਼ਾਇਨ ਬਣ ਜਾਂਦਾ ਹੈ ਇੱਕ ਸ਼ਬਦ ਸ਼ਕਤੀ ਵਿਗਿਆਨਿਕ ਅਰਥਾਂ ਵਿੱਚ ਮੋਨੋਕ੍ਰੈਮੈਟਿਕ ਨਹੀਂ ਹੈ ਵਾਸਤਵਿਕ ਕਲਾ ਜਗਤ ਵਿੱਚ ਜਿਹੜੇ ਮੋਨੋਕ੍ਰੈਮੈਟਿਕ ਹੈ ਬਹੁ ਰੰਗੀ ਕਲਾਵਾਂ ਨਾਲੋਂ ਗੁੰਝਲਦਾਰ ਅਤੇ ਗੁੰਝਰਦਾਰ ਹੋਰ ਵੀ ਹੋ ਸਕਦੀਆਂ ਹਨ ਧੰਨਵਾਦ